ਛੱਬੀ ਜਨਵਰੀ ਉੱਨੀ ਸੌ ਪੰਜਾਹ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਇੱਕੀ ਫਰਵਰੀ ਉੱਨੀ ਸੌ ਚੁਰਾਸੀ ਛੱਬੀ ਅਕਤੂਬਰ ਉੱਨੀ ਸੌ ਸੰਨਤਾਲੀ ਤੇਈ ਨਵੰਬਰ ਦੋ ਹਜ਼ਾਰ ਇੱਕ